ਮੁਟਿਆਰਾਂ ਸੂਟ ਸਲਵਾਰ ਪਾਉਂਦੀਆਂ ਹਨ ਅਤੇ ਸਿਰ ਉੱਤੇ ਚੁੰਨੀ ਰੱਖਦੀਆਂ ਹਨ ਉਹਨਾਂ ਦੇ ਪੈਰ ਪੰਜਾਬੀ ਜੁੱਤੀ ਹੁੰਦੀ ਹੈ ਇਸ ਤਰਾਂ ਉਹ ਭੰਗੜੇ ਲਈ ਤਿਆਰ ਹੁੰਦੀਆਂ ਹਨ ਅਤੇ ਸਾਡੇ ਗੱਭਰੂ ਜਵਾਨ ਕੁੜਤਾ ਪਾਉਂਦੇ ਹਨ ਚਾਦਰਾ ਪਾਉਂਦੇ ਹਨ ਅਤੇ ਸਿਰ ਉੱਤੇ ਪੱਗ ਜ਼ਰੂਰ ਹੁੰਦੀ ਹੈ ਉਹਨਾਂ ਦੇ ਗਲ਼ੇ ਵਿੱਚ ਕੈਂਠਾ ਹੁੰਦਾ ਹੈ ਅਤੇ ਪੈਰਾਂ ਵਿੱਚ ਪੰਜਾਬੀ ਜੁੱਤੀ ਹੁੰਦੀ ਹੈ ਇਸ ਤਰਾਂ ਉਹ ਆਪਣੇ ਇਸ ਅਲੱਗ ਪਹਿਨਾਵੇ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ ਉਹਨਾਂ ਦਾ ਇਹ ਪਹਿਰਾਵਾ ਕਾਫੀ ਆਕਰਸ਼ਕ ਹੁੰਦਾ ਹੈ ਅਤੇ ਉਹਨਾਂ ਨੂੰ ਸਭ ਤੋਂ ਅਲੱਗ ਬਣਾਉਂਦਾ ਹੈ